ਬਰਤਨਾਂ ਨੂੰ ਧੋਣ ਦੇ ਲਈ ਸਾਫ਼ ਪਾਣੀ ਅਤੇ ਸਰਫ ਦੀ ਲੋੜ ਹੁੰਦੀ ਹੈ ਸਭ ਤੋਂ ਪਹਿਲਾਂ ਸਰਫ ਨੂੰ ਸਕ੍ਰੱਬਰ ਦੇ ਉੱਤੇ ਪਾਓ ਅਤੇ ਬਰਤਨਾਂ ਨੂੰ ਬਰਤਨਾਂ ਦੇ ਉੱਤੇ ਲਗਾ ਕੇ ਸਾਫ਼ ਪਾਣੀ ਦੇ ਵਿੱਚੋਂ ਕੱਢ ਦੇਵੋ ਜੇ ਬਰਤਨਾਂ ਦੇ ਉੱਤੇ ਤੇਲ ਲੱਗਿਆ ਹੋਇਆ ਹੈ ਤਾਂ ਅਸੀਂ ਗਰਮ ਪਾਣੀ ਦਾ ਉਪਯੋਗ ਕਰ ਸਕਦੇ ਹਾਂ ਅਤੇ ਉਸਨੂੰ ਸਟੀਲ ਵੂਲ ਵਾਲੇ ਸਕ੍ਰੱਬਰ ਦੇ ਨਾਲ ਰਗੜ ਕੇ ਧੋ ਸਕਦੇ ਹਾਂ ਇਹ ਵੀ ਕਿਹਾ ਜਾਂਦਾ ਹੈ ਕਿ ਕਈ ਵਾਰ ਨਿੰਬੂ ਰਗੜਨ ਦੇ ਨਾਲ ਵਰਤਣਾ ਦੇ ਉੱਤੋਂ ਤੇਲ ਖ਼ਤਮ ਹੋ ਜਾਂਦਾ ਹੈ ਜੇ ਤੇਲ ਜ਼ਿਆਦਾ ਲੱਗਿਆ ਹੋਵੇ ਤਾਂ ਬਰਤਨਾਂ ਨੂੰ ਥੋੜ੍ਹੀ ਦੇਰ ਗਰਮ ਪਾਣੀ ਦੇ ਵਿੱਚ ਭਿਗੋ ਕੇ ਛੱਡ ਦੇਵੋ ਉਸ ਤੋਂ ਬਾਅਦ ਸਰਫ ਰਗੜ ਕੇ ਚੰਗੀ ਤਰ੍ਹਾਂ ਧੋ ਲਓ ਇਸ ਤਰ੍ਹਾਂ ਤੇਲ ਬਰਤਨਾਂ ਨਾਲੋਂ ਛੁੱਟ ਜਾਂਦਾ ਹੈ ਅਤੇ ਬਰਤਨ ਚਮਕ ਜਾਂਦੇ ਹਨ